ਅੱਠ ਅਗਸਤ ਦੋ ਹਜ਼ਾਰ ਬਾਰਾਂ ਅਕਤੂਬਰ ਦੋ ਹਜ਼ਾਰ ਇੱਕ ਦੋ ਫਰਵਰੀ ਦੋ ਹਜ਼ਾਰ ਪੰਜ ਵੀਹ ਨਵੰਬਰ ਉੱਨੀ ਸੌ ਅਠਾਨਵੇਂ ਚੌਦਾਂ ਦਸੰਬਰ ਉੱਨੀ ਸੌ ਨੜ੍ਹਿਨਵੇਂ